ਸਿੱਖ ਇਤਿਹਾਸ ਇੱਕ ਅਜਿਹਾ ਇਤਿਹਾਸ ਹੈ ਜਿਹੜੀ ਜਿਸ ਦੀ ਇਤਿਹਾਸਕਾਰੀ ਜਾਂ ਕੁਰਬਾਨੀ ਵੱਖਰੀ ਹੈ ਵੱਖਰੀ ਹੋਂਦ ਹੈ ਵੱਖਰੀ ਹੀ ਕਈ ਇਹੋ ਜਿਹੀਆਂ ਗੱਲਾਂ ਨੇ ਜਿਹੜੀਆਂ ਸਾਨੂੰ ਕਿਤੇ ਮਿਲਦੀਆਂ ਹੀ ਨਹੀਂ ਇਹ ਸਿੱਖ ਇਤਿਹਾਸ ਵਿੱਚ ਕੋਈ ਵੀ ਕਿਸੇ ਦੀ ਰਾਜਸ਼ਾਹੀ ਜਾਂ ਕਿਸੇ ਦੀ ਜਿਹਾ ਵਾਸਤੇ ਜਾਂ ਹੋਰ ਵਾਸਤੇ ਨਹੀਂ ਹੋਇਆ ਬਣਿਆ ਨਾ ਹੀ ਕਿਸੇ ਨੇ ਉਹ ਕੀਤਾ ਜ਼ੁਲਮ ਦੇ ਖਿਲਾਫ਼ ਜ਼ੁਲਮ ਦੇ ਆਵਾਜ਼ ਆਵਾਜ਼ ਉਠਾਈ ਅਤੇ ਗੁਰੂ ਦਸਵੇਂ ਪਾਤਸ਼ਾਹ ਨੇ ਸਿੱਖ ਸਾਜੇ ਪੰਜ ਪਿਆਰੇ ਬਣਾਏ ਉੱਥੋਂ ਇਹ ਪ੍ਰਥਾ ਚਲੀ ਸਿੱਖ ਇਤਿਹਾਸ ਇੱਕ ਕੁਰਬਾਨੀਆਂ ਭਰਿਆ ਹੈ ਸਿੱਖ ਇਤਿਹਾਸ ਦੇ ਵਿੱਚ ਕਈ ਅਜਿਹੇ ਕੀ ਆਏ ਯੋਗਦਾਨ ਆਏ ਨੇ ਫਿਰ ਯਾਦ ਕੀਤੇ ਜਾਂਦੇ ਨੇ ਸਿੱਖ ਇਤਿਹਾਸ ਦੇ ਵਿੱਚ ਮਾਈ ਭਾਗੋ ਮਾਈ ਭਾਗੋ ਰਾਮ ਰਾਮ ਭਰੀ ਇਹ ਜਿਵੇਂ ਚਮਕੌਰ ਦੀ ਗੜੀ ਦੇ ਵਿੱਚ ਜੰਗ ਚੱਲ ਰਿਹਾ ਸੀ ਤਾਂ ਪ ਕਈ ਆਪਣੇ ਸਿੰਘ ਬ ਭੁੱਖੇ ਪਿਆਸੇ ਹੋਣ ਕਰਕੇ ਦਸਵੇਂ ਪਾਤਸ਼ਾਹ ਨੂੰ ਲਿਖ ਕੇ ਦੇ ਗਏ ਦਾਵਾ ਬੇਦਾਵਾ ਵੀ ਅਸੀਂ ਤੇਰੇ ਗੁਰੂ ਨਹੀਂ ਸਿੱਖ ਚੇਲੇ ਨਹੀਂ ਤੂੰ ਸਾਡਾ ਗੁਰੂ ਨਹੀਂ ਉੱਥੋਂ ਉਹ ਘਰੇ ਆਏ ਤਾਂ ਮਾਈ ਭਾਗੋ ਨੇ ਉਹਨਾਂ ਨੂੰ ਬਹੁਤ ਚੰਗਾ ਮਾੜਾ ਕਿਹਾ ਅਤੇ ਆਪ ਤਲਵਾਰ ਲੈ ਕੇ ਜੰਗ ਦੇ ਮੈਦਾਨ ਵਿੱਚ ਆ ਗਈ ਉੱਥੋਂ ਉਹ ਜਿਹੜੇ ਉਹ ਮੁੜੇ ਸੀ ਵਾਪਸ ਸਿੰਘ ਉਹਨਾਂ ਨੇ ਬੜੀ ਇਸ ਚੀਜ਼ ਦੀ ਸ਼ਰਮ ਮੰਨੀ ਅਤੇ ਚੱਕ ਕੇ ਤਲਵਾਰਾਂ ਦੁਬਾਰੇ ਆ ਕੇ ਲੜਾਈ ਲੜਨ ਲੱਗ ਪਏ ਸ਼ਹੀਦ ਹੋ ਗਏ ਕਈ ਡਿੱਗੇ ਪਏ ਨੇ ਦਸਵੇਂ ਪਾਤਸ਼ਾਹ ਨੇ ਉਹਨਾਂ ਦਾ ਹਾਲ ਚਾਲ ਪੁੱਛਿਆ ਹੋਰ ਗੱਲਾਂ ਕੀਤੀਆਂ ਤਾਂ ਵਿੱਚੋਂ ਸਿੰਘ ਬੋਲਦੇ ਨੇ ਵੀ ਮਹਾਰਾਜ ਸਾਡੇ ਤੋਂ ਗਲਤੀ ਹੋ ਗਈ ਸੀ ਸਾਡਾ ਉਹ ਬੇਦਾਵਾ ਪਾੜ ਦਿਓ ਅਤੇ ਦਸਵੇਂ ਪਾਤਸ਼ਾਹ ਨੇ ਉਹਨੂੰ ਵਰ ਦਿੱਤਾ ਅਤੇ ਬੇਦਾਵਾ ਪਾੜਿਆ ਇਸ ਤਰੀਕੇ ਨਾਲ ਸਾਹਿਬਜ਼ਾਦਿਆਂ ਬਾਰੇ ਵੀ ਇਸ ਤਰ੍ਹਾਂ ਕੁਰਬਾਨੀਆਂ ਦਿੱਤੀਆਂ ਅਤੇ ਮਾਤਾ ਸੁੰਦਰੀ ਮਾਤਾ ਸੁੰਦਰੀ ਪਤਨੀ ਸ਼੍ਰੀ ਗੋ ਗੋਬਿੰਦ ਸਿੰਘ ਦੀ ਮਾਤਾ ਗੁਜਰੀ ਇਹ ਵੀ ਪਤਨੀ ਹੈ ਬੀਬੀ ਗੰਗਾ ਗੁਰੂ ਅਰਜਨ ਦੇਵ ਜੀ ਦੀ ਪਤਨੀ ਹੈ ਅਤੇ ਸ਼੍ਰੀ ਹਰਗੋਬਿੰਦ ਸਾਹਿਬ ਦੀ ਮਾਤਾ ਹੈ ਮਾਤਾ ਖੀਵੀ ਗੁਰੂ ਅਰਜਨ ਦੇਵ ਦੇ ਪਤਨੀ ਹੈ ਅਤੇ ਲੰਗਰ ਦੀ ਪ੍ਰਥਾ ਮਾਤਾ ਖੀਵੀ ਨੇ ਚਲਾਈ ਇਸ ਤਰੀਕੇ ਨਾਲ ਸਿੱਖ ਇਤਿਹਾਸ ਦੇ ਵਿੱਚ ਅਜਿਹਾ ਯੋਗਦਾਨ ਪਾਇਆ ਜਿਹੜਾ ਅੱਜ ਵੀ ਯਾਦ ਕੀਤਾ ਜਾਂਦਾ ਹੈ ਸਿੱਖ ਇਤਿਹਾਸ ਵਰਗਾ ਕੋਈ ਵੀ ਇਤਿਹਾਸ ਨਹੀਂ ਜਿਹਨੂੰ ਜਿਹਨੂੰ ਜਾਣਿਆ ਜਾਵੇ ਸਿੱਖ ਇਤਿਹਾਸ ਕੋਈ ਜਾਣ ਲੈਂਦਾ ਹੈ ਤਾਂ ਉਹੀ ਬੰਦਾ ਕਹਿੰਦਾ ਹੈ ਵੀ ਜ਼ੁਲਮ ਦੇ ਖਿਲਾਫ਼ ਲੜੋ ਗਰੀਬਾਂ ਦੀ ਮਦਦ ਕਰੋ ਲੜਕੀਆਂ ਦੀ ਮਦਦ ਕਰੋ ਇਸ ਤਰੀਕੇ ਨਾਲ ਸਿੱਖ ਇਤਿਹਾਸ ਦਾ ਯੋਗਦਾਨ ਬਹੁਤ ਹੀ ਜ਼ਿਆਦਾ ਹੈ ਸਿੱਖ ਇਤਿਹਾਸ ਨੂੰ ਯਾਦ ਕਰਦਿਆਂ ਬਹੁਤ ਵਧੀਆ ਲੱਗਦਾ ਹੈ